ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਪਾਲ ਢਾਬੇ ਤੋਂ ਬੋਲ ਰਹੇ ਮੈਂ ਤੁਹਾਡੇ ਨਾ ਸਵਿਗੀ ਐਪਲੀਕੇਸ਼ਨ ਤੋਂ ਔਰਡਰ ਕੀਤਾ ਸੀ ਇੱਥੇ ਮੈਨੂੰ ਤੁਹਾਡੀ ਸਰਵਿਸ ਬਹੁਤ ਵਧੀਆ ਲੱਗੀ ਮੈਂ ਇੱਥੇ ਤੋਂ ਦਾਲ ਮੱਖਣੀ ਔਰ ਸ਼ਾਹੀ ਪਨੀਰ ਔਰ ਛੇ ਫੁਲਕੇ ਔਰਡਰ ਕੀਤੇ ਸੀ ਉਹਦੇ ਨਾਲ ਮੈਨੂੰ ਵੀਹ ਪਰਸੈਂਟ ਡਿਸਕਾਊਂਟ ਮਿਲਿਆ ਮੈਂ ਅੱਗੇ ਤੋਂ ਜੀ ਤੁਹਾਡੇ ਢਾਬੇ ਤੋਂ ਹੀ ਔਰਡਰ ਕਰਿਆ ਕਰਾਂਗੀ ਤਾਂ ਕਿ ਮੈਨੂੰ ਅੱਗੇ ਤੋਂ ਵੀ ਹੋਰ ਮੁਨਾਫ਼ਾ ਹੋ ਸਕੇ